ਮੈਂ ਆਪਣੇ ਘਰ ਦੇ ਲਈ ਕਰਜ਼ੇ ਵਾਸਤੇ ਅਰਜ਼ੀ ਦੇਣੀ ਹੈ ਅਤੇ ਉਸ ਦੇ ਵਿੱਚ ਮੈਨੂੰ ਇੱਕ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਉਸ ਉਨ੍ਹਾਂ ਨੇ ਪਿਛਲੇ ਸਾਲ ਦੇ ਸਾਰੇ ਬਿੱਲਾਂ ਦੀ ਇੱਕ ਸਟੇਟਮੈਂਟ ਦੀ ਜ਼ਰੂਰਤ ਕੀਤੀ ਹੈ ਅਤੇ ਇਸ ਵਾਸਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਵੈਬਸਾਈਟ ਦੇ ਵਿੱਚ ਕਿਤੇ ਲਿੰਕ ਹੈ ਜਿਸ ਤੋਂ ਮੈਂ ਆਪਣੇ ਇੱਕ ਸਾਲ ਦੀ ਸਟੇਟਮੈਂਟ ਪ੍ਰਾਪਤ ਕਰ ਸਕਾਂ ਕਿਰਪਾ ਕਰਕੇ ਇਸ ਦਾ ਪੂਰਾ ਵੇਰਵਾ ਦਿੱਤਾ ਜਾਵੇ ਤਾਂ ਜੋ ਮੈਂ ਆਪਣੀ ਇੱਕ ਸਾਲ ਦੀ ਸਟੇਟਮੈਂਟ ਉੱਥੇ ਲਗਾ ਕੇ ਆਪਣਾ ਕਰਜ਼ਾ ਪ੍ਰਾਪਤ ਕਰ ਸਕਾਂ